ਦੇਖੋ ਜੀ ਮੈਂ ਇੱਕ ਸਾਦੇ ਸੂਟ ਦਾ ਜਿਹੜਾ ਰੇਟ ਹੈਗਾ ਵੀ ਉਹ ਸਾਢੇ ਤਿੰਨ ਸੌ ਰੁਪਏ ਜਿਵੇਂ ਜਿਹੜਾ ਰੇਟ ਚੱਲ ਰਿਹਾ ਅੱਜ ਦੇ ਟਾਈਮ ਦੇ ਵਿੱਚ ਹੈ ਨਾ ਮੈਂ ਉਹ ਲੈਂਦੀ ਹੈਗੀ ਜੇ ਕੋਈ ਮਤਲਬ ਜਿਹੜਾ ਦੇਣ ਮਤਲਬ ਨਹੀਂ ਜ਼ਿਆਦਾ ਦੇ ਸਕਦਾ ਤਾਂ ਮੈਂ ਉਹ ਤੋਂ ਆਪਾਂ ਘੱਟ ਵੀ ਕਰ ਲੈਂਦੀ ਹੈਗੀ ਜਿਵੇਂ ਸ ਜਿਹੜਾ ਸਿੰਪਲ ਸਲਵਾਰ ਆਪਾਂ ਸਾਦਾ ਜਿਹੜਾ ਕਹਿ ਸਕਦੇ ਹਾਂ ਸਲਵਾਰ ਸੂਟ ਵੀ ਜਿਹੜੀ ਸਿਲਾਈ ਹੈਗੀ ਉਹ ਢਾਈ ਸੌ ਰੁਪਇਆ ਹੈਗੀ ਜੇ ਆਪਾਂ ਥੋੜ੍ਹਾ ਬਹੁਤ ਡਿਜਾਇਨਿੰਗ ਕਰਵਾਉਣੀ ਆ ਗਲੇ ਦੇ ਉੱਤੇ ਜਾਂ ਘੇਰੇ ਦੇ ਉੱਤੇ ਬਾਹਾਂ ਦੇ ਉੱਤੇ ਤਾਂ ਉਹਦਾ ਰੇਟ ਕੀ ਹੈਗਾ ਵੱਧ ਜਾਂਦਾ ਉਹ ਅਤੇ ਆਪਾਂ ਲੈਸ ਲੂਸ ਲਾਉਣੀ ਆ ਤਾਂ ਉਹਦਾ ਵੀ ਰੇਟ ਪੰਜਾਹ ਰੁਪਏ ਹੈਗਾ ਜੀ ਮੇਰਾ ਇਹਦਾ ਅਤੇ ਬਾਕੀ ਅਲੱਗ ਅਲੱਗ ਨੇ ਜਿਵੇਂ ਚੂੜੀਦਾਰ ਬਾਹਾਂ ਨੇ ਪੈਂਟ ਪਲਾਜੋ ਆ ਉਹਦਾ ਰੇਟ ਫੇਰ ਵੱਖਰਾ ਹੈਗਾ ਜੇ ਪੈਂਟ ਪਲਾਜੋ ਬਣਾਉਣਾ ਗਾ ਜੀ ਦੇਖੋ ਤਾਂ ਸਾਢੇ ਤਿੰਨ ਸੌ ਰੁਪਏ ਰੇਟ ਹੈਗਾ ਚੱਲਦਾ ਜਿਹੜਾ ਅਤੇ ਬਾਕੀ ਫੁੱਲ ਸੂਟ ਦਾ ਜੇ ਆਪਾਂ ਲਾਈਨਿੰਗ ਵਾਲਾ ਲਈਏ ਤਾਂ ਪੈਂਟ ਪਲਾਜ਼ੋ ਆਪਾਂ ਨਾਲ ਕਹਿ ਦਈਏ ਤਾਂ ਸਾਢੇ ਪੰਜ ਸੌ ਰੁਪਏ ਸਿਲਾਈ ਹੈ ਜੀ ਅਤੇ ਮੈਂ ਸਾਦੇ ਸੂਟ ਤਾਂ ਲੈਂਦੀ ਹਾਂ ਜੀ ਸਾਢੇ ਤਿੰਨ ਸੌ ਅਤੇ ਵੱਧ ਤੋਂ ਵੱਧ ਮੈਂ ਤਿੰਨ ਸੌ ਰੁਪਏ ਕਰ ਲੈਂਦੀ ਹਾਂ ਇਸ ਤੋਂ ਘੱਟ ਨਹੀਂ ਅਤੇ ਜੇ ਆਪਾਂ ਲਾਈਨਿੰਗ ਵਾਲਾ ਬਣਾਉਣਾ ਸੂਟ ਤਾਂ ਫੁੱਲ ਸੂਟ ਆਦਿ ਉਹਦਾ ਸਾਢੇ ਪੰਜ ਸੌ ਜੇ ਆਪਾਂ ਲਾਈਨਿੰਗ ਵਾਲਾ ਪੈਂਟ ਪਲਾਜੋ ਬਣਾਉਣਾ ਹੈਗਾ ਤਾਂ ਉਹਦਾ ਵੀ ਸਾਢੇ ਪੰਜ ਸੌ ਅਤੇ ਬਾਕੀ ਜੇ ਆਪਾਂ ਸਿੰਪਲ ਜਿਹੜੀ ਸਾਦੀ ਜਿਹੜੀ ਇੱਕ ਕਾਟਨ ਦੀ ਜਿਹੜੀ ਕੁੜਤੀ ਬਣਾਉਣੀ ਹੈ ਤਾਂ ਉਹਦਾ ਦੋ ਸੌ ਰੁਪਏ ਰੇਟ ਆ ਜੀ ਮੇਰਾ